ਸਭ ਤੋਂ ਪਹਿਲਾਂ ਇਹ ਹੈ ਕਿ ਜਦੋਂ ਵੀ ਅਸੀਂ ਖਾਣਾ ਬਣਾਉਣਾ ਹੈ ਇਸਦੀ ਸਭ ਤੋਂ ਵੱਡੀ ਸਾਵਧਾਨੀ ਇਹ ਹੈ ਕਿ ਅਸੀਂ ਜਿਸ ਜਗ੍ਹਾ 'ਤੇ ਖਾਣਾ ਬਣਾਉਣਾ ਹੈ ਜਿਸ ਰਸੋਈ ਵਿੱਚ ਖਾਣਾ ਬਣਾਉਣਾ ਹੈ ਉਹ ਸਾਫ ਅਤੇ ਸੁਥਰੀ ਹੋਵੇ ਤਾਂ ਜੋ ਉਥੇ ਕੋਈ ਮੱਖੀ ਜਾਂ ਮੱਛਰ ਵੀ ਨਾ ਆ ਸਕੇ ਜੋ ਵੀ ਅਸੀਂ ਸਬਜ਼ੀ ਬਣਾਉਂਦੇ ਹਾਂ ਉਸਨੂੰ ਚੰਗੀ ਤਰ੍ਹਾਂ ਧੋ ਕੇ ਹੀ ਅਸੀਂ ਉਸਨੂੰ ਬਣਾ ਸਕੀਏ ਔਰ ਜਦ ਕੋਈ ਸਬਜ਼ੀ ਜਾਂ ਕੋਈ ਵੀ ਡਿਸ਼ ਬਣ ਜਾਂਦੀ ਹੈ ਤਾਂ ਉਸਨੂੰ ਅਸੀਂ ਚੰਗੀ ਤਰ੍ਹਾਂ ਢੱਕ ਕੇ ਰੱਖੀਏ ਤਾਂ ਜਾ ਕੋਈ ਕੀੜਾ ਜਾਂ ਮੱਖੀ ਉਥੇ ਨਾ ਆ ਸਕੇ ਸਭ ਤੋਂ ਵੱਡੀ ਗੱਲ ਇਹ ਹੈ ਕੀ ਜਦ ਤੁਹਾਡੀ ਰਸੋਈ ਸਾਫ ਸੁਥਰੀ ਹੋਵੇਗੀ ਤਾਂ ਉੱਥੇ ਮੱਖੀ ਮੱਛਰ ਬਿਲਕੁਲ ਵੀ ਨਹੀਂ ਆ ਸਕਦਾ ਸਭ ਤੋਂ ਵੱਡੀ ਸਾਵਧਾਨੀ ਇਹੀ ਹੈ ਕਿ ਅਸੀਂ ਜਿਸ ਜਗ੍ਹਾ 'ਤੇ ਖਾਣਾ ਬਣਾਉਣਾ ਹਾਂ ਉਹ ਸਾਫ ਸੁਥਰੀ ਹੋਵੇ ਤਾਂ ਜੋ ਜੋ ਵੀ ਅਸੀਂ ਚੀਜ਼ ਬਣਾਈ ਹੈ ਖਾਣ ਵਾਲੇ ਵਿਅਕਤੀ ਨੂੰ ਵੀ ਪਸੰਦ ਆਵੇ ਔਰ ਉਸਨੂੰ ਕੋਈ ਰੋਗ ਨਾ ਹੋਵੇ